ਮੈਂ ਆਪਣੇ ਘਰ ਦੇ ਇਲਾਕਿਆਂ ਨੂੰ ਸਾਫ ਸੁਫਕ ਜਾਂ ਖਾਲੀ ਜੋ ਵੀ ਮੇਰੇ ਕੋਲ ਹਿੰਮਤ ਹੁੰਦੀ ਹੈ ਮੈਂ ਉਹ ਕਰਦਾ ਹਾਂ ਬਾਕੀ ਮੈਂ ਆਪਣੇ ਦੋਸਤਾਂ ਨਾਲ ਰਲ ਕੇ ਰੋਜ਼ ਸਵੇਰੇ ਜੋ ਵੀ ਲੋਕ ਕਚਰਾ ਪਾਉਂਦੇ ਉਹਨਾਂ ਦੇ ਪੱਤੇ ਵਗੈਰਾ ਜੋ ਬੂਟਿਆਂ ਦੇ ਪੱਤੇ ਵਗੈਰਾ ਚੜ੍ਹਦੇ ਹੈ ਕੋਈ ਲੇਜ਼ ਖਾ ਕੇ ਸੁੱਟ ਰਿਹਾ ਹੈ ਕੋਈ ਕੁਰਕੁਰੇ ਖਾ ਕੇ ਸੁੱਟ ਰਿਹਾ ਉਹਦੇ ਜਿੰਨੇ ਵੀ ਪੋਲੀਥੀਨ ਲਿਫਾਫੇ ਵਗੈਰਾ ਹੁੰਦੇ ਹੈ ਉਹਨਾਂ ਨੂੰ ਚੁੱਕ ਕੇ ਜਦੋਂ ਵੀ ਮੈਨੂੰ ਦਿਸਦੇ ਹੈ ਅਤੇ ਅਸੀਂ ਡਸਟਬੀਨ 'ਚ ਪਾ ਕੇ ਜਦੋਂ ਵੀ ਮੋਰਨਿੰਗ ਵੋਕ 'ਤੇ ਜਾਂਦੇ ਹਾਂ ਜਾਂ ਸ਼ਾਮ ਨੂੰ ਵੋਕ 'ਤੇ ਜਾਂਦੇ ਹਾਂ ਜਾਂ ਕਿਤੇ ਵੀ ਕੰਮ ਗਏ ਹੋਈਏ ਉੱਥੇ ਸਾਨੂੰ ਜਦੋਂ ਵੀ ਕੁਛ ਇੱਦਾਂ ਦੀ ਚੀਜ਼ ਲੱਭਦੀ ਹੈ ਅਤੇ ਅਸੀਂ ਉਹਨੂੰ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਹਾਂ ਕਿ ਲੋਕ ਗੰਦਗੀ ਨਾ ਫੈਲਾਉਣ ਅਤੇ ਉਹਨੂੰ ਅਸੀਂ ਚੁੱਕ ਕੇ ਅਤੇ ਡਸਟਬੀਨ ਲਾਗੇ ਛਾਗੇ ਜਿੱਥੇ ਹੋਏ ਜਾਂ ਕੂੜਾ ਪਾਉਣ ਨੂੰ ਜੋ ਵੀ ਹੋਊਗਾ ਬੋਕਸ ਵਗੈਰਾ ਰੱਖਿਆ ਹੋਇਆ ਕਿਸੇ ਨੇ ਉਹਦੇ ਵਿੱਚ ਕੂੜੇਦਾਨ ਦੇ ਵਿੱਚ ਪਾ ਦਿੰਦੇ ਹਾਂ ਅਤੇ ਬਾਕੀ ਸਾਡਾ ਜੋ ਵੀ ਇਲਾਕੇ ਦਾ ਮੇਅਰ ਹੈ ਡੀ ਐਮ ਸੀ ਸਾਹਿਬ ਨੇ ਜਾਂ ਸਰਪੰਚ ਹੈ ਉਹ ਕਾਫੀ ਸਾਡੀ ਮਦਦ ਕਰਦੇ ਨੇ ਅਤੇ ਉਹ ਵੀ ਸਾਫ ਸਫਾਈ ਰੱਖਣ 'ਚ ਬਾਕੀਆਂ ਨੂੰ ਵੀ ਅਸੀਂ ਗਾਈਡ ਕਰਦੇ ਹਾਂ ਬਾਕੀਆਂ ਨੂੰ ਵੀ ਕਹਿੰਦੇ ਹਾਂ ਅਤੇ ਬਹੁਤ ਹੀ ਵਧੀਆ ਸਾਫ ਸਫਾਈ ਤਰੀਕੇ ਨਾਲ ਰਹਿੰਦੇ ਹੈ ਰੁੱਖ ਲਗਾਏ ਅਸੀਂ ਬੜੇ ਮੈਂ ਅਤੇ ਮੇਰੇ ਫਰੈਂਡ ਸਰਕਲ ਦੋਸਤਾਂ ਮੇਰਿਆਂ ਨੇ ਬਹੁਤ ਜ਼ਿਆਦਾ ਰੁੱਖ ਲਗਾਏ ਨੇ ਆਪਣੇ ਲਾਗੇ ਛਾਗੇ ਘਰਾਂ ਦੇ ਨੇੜੇ ਆਪਣੀ ਕਲੋਨੀ 'ਚ ਅਸੀਂ ਪੂਰੇ ਰੁੱਖ ਲਗਾਏ ਹੋਏ ਨੇ ਅਤੇ ਜ਼ਿਆਦਾਤਰ ਅਸੀਂ ਪਪੂਲਰ ਲਗਾਏ ਨੇ ਜਾਂ ਦਰੇਕ ਲਗਾਈ ਹੈ ਅਤੇ ਕੁਝ ਕੁ ਬੂਟੇ ਅਸੀਂ ਨਿੰਮ ਦੇ ਵੀ ਲਗਾਏ ਹੋਏ ਨੇ ਕਿਉਂਕਿ ਨਿੰਮ ਨਾਲ ਕਹਿੰਦੇ ਕਿ ਜਿਹੜੀ ਨੈਗਟਿਵ ਊਰਜਾ ਉਹ ਵੀ ਖਤਮ ਹੁੰਦੀ ਹੈ ਅਤੇ ਬਾਕੀ ਨਿੰਮ ਹੋਰ ਬਹੁਤ ਸਾਰੀਆਂ ਗੰਦਗੀ ਬਿਮਾਰੀਆਂ ਨੂੰ ਭਜਾਉਣ 'ਚ ਉਹ ਮਦਦਗਾਰ ਹੁੰਦੀ ਹੈ ਅਤੇ ਮੈਂ ਆਪ ਸਾਰਿਆਂ ਨੂੰ ਰਿਕੁਐਸਟ ਕਰਦਾ ਬੇਨਤੀ ਕਰਦਾ ਕਿ ਤੁਸੀਂ ਵੀ ਆਪਣੇ ਇਲਾਕੇ ਦੇ ਵਿੱਚ ਵੱਧ ਤੋਂ ਵੱਧ ਸਫਾਈ ਰੱਖੋ ਮਿਹਰਬਾਨੀ